ਹਾਂ ਮੈਂ ਡਾਂਸ ਰੀਲਾ ਸ਼ੋਰਟੇਜ ਦੇਖਦੀ ਹਾਂ ਮੈਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੀ ਹਾਂ ਜਦੋਂ ਵੀ ਮੈਂ ਫਰੀ ਹੁੰਦੀ ਹਾਂ ਮੈਂ ਉਸ ਉਹਨਾਂ ਨੂੰ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੀ ਹਾਂ ਜਦੋਂ ਇਹ ਇਹ ਮੇਰੇ ਲਈ ਬਹੁਤ ਹੀ ਮਹੱਤਵਪੂਰਨ ਰੱਖਦੇ ਹਨ ਕਿਉਂਕਿ ਇਹ ਮੈਨੂੰ ਹੱਸ ਹਾਸਾ ਮਖੌਲ ਕਰਨ ਵਿੱਚ ਵੀ ਕਾਫ਼ੀ ਮਦਦ ਕਰਦੇ ਹਨ ਅਤੇ ਮੈਂ ਇਹਨਾਂ ਦੀਆਂ ਬਹੁਤ ਸਾਰੀਆਂ ਵੀਡੀਓ ਦੇਖਦੀ ਹਨ ਜਿਵੇਂ ਕਿ ਕੁਝ ਫੇਮਸ ਜ ਬਹੁਤ ਹੀ ਫੇਮਸ ਡਾਂਸਰ ਹਨ ਉਹਨਾਂ ਦੇ ਨਾਮ ਮੈਂ ਦੱਸਣਾ ਚਾਹੁੰਦੀ ਹਾਂ ਜਿਵੇਂ ਕਿ ਪ੍ਰਿਯੰਕਾ ਚਾਹਰ ਚੌਧਰੀ ਈਸ਼ਾ ਮਾਲਵੀਆ ਸੁਸ਼ਾਂਤ ਖੱਤਰੀ ਨਿਮਰਤ ਖੈਰਾ ਆਕਾਸ਼ ਤਾਪਾ ਦਾਨਾ ਸ਼੍ਰੀ ਵਰਮਾ ਸਰਗੁਣ ਮਹਿਤਾ ਗੁਰਨਾਮ ਭੁੱਲਰ ਅਨਮੋਲ ਗਗਨਮਾਨ ਇਹ ਕਿ ਇਹ ਬਹੁਤ ਹੀ ਪ੍ਰਸਿੱਧ ਡਾਂਸਰ ਹਨ ਜੋ ਕਿ ਬਹੁਤ ਸਾਰੀਆਂ ਰੀਲਾਂ ਨੂੰ ਬਣਾਉਂਦੇ ਹਨ ਇਹ ਦਿਨ ਵਿੱਚ ਕਈ ਕਈ ਕਈ ਤਰ੍ਹਾਂ ਦੀਆਂ ਰੀਲਾਂ ਬਣਾਉਂਦੇ ਹਨ ਜਿਵੇਂ ਕਿ ਡਾਂਸ ਦੇ ਤੌਰ 'ਤੇ ਕਈ ਤੌਰ 'ਤੇ ਬਣਾਉਂਦੇ ਹਨ